ਗਰਾਊਂਡ ਵਿੱਚ ਦੌੜ੍ਹਦੇ ਸਮੇਂ ਮੈਂ ਸਮਾਰਟ ਵਾਚ ਦੀ ਵਰਤੋਂ ਕਰਦਾ ਹਾਂ ਇਸ ਨਾਲ ਮੈਨੂੰ ਆਪਣੇ ਸਰੀਰ ਦੀ ਸਾਰੀ ਹਰਕਤ ਦਾ ਪਤਾ ਚੱਲਦਾ ਰਹਿੰਦਾ ਹੈ ਰੋਜ਼ਾਨਾ ਆਪਣੀ ਸਿਹਤ ਨੂੰ ਸਹੀ ਰੱਖਣ ਲਈ ਮੈਂ ਆਪਣੇ ਖਾਣ ਪੀਣ ਦਾ ਬਹੁਤ ਧਿਆਨ ਰੱਖਦਾ ਹਾਂ